ਹਾਂਜੀ ਮੈਂ ਜਦੋਂ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਮੈਂ ਲੰਬੀ ਦੂਰੀ ਦੀ ਦੌੜ ਵਿੱਚ ਹਿੱਸਾ ਲਿਆ ਸੀ ਮੈਨੂੰ ਸਪੋਰਟਸ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਕਰਨਾ ਬਹੁਤ ਹੀ ਪਸੰਦ ਸੀ ਮੈਂ ਕਈ ਹੋਰ ਵੀ ਸਪੋਰਟਸ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਵੀ ਲਿਤਾ ਸੀ ਜਿਨ੍ਹਾਂ ਵਿੱਚੋਂ ਮੈਂ ਫਸਟ ਪੋਜੀਸ਼ਨ 'ਤੇ ਆਈ ਦੌੜ ਵਿੱਚੋਂ ਵੀ ਮੈਂ ਫਸਟ ਪੋਜੀਸ਼ਨ 'ਤੇ ਆਈ ਸੀ ਇਸ ਦੀ ਤਿਆਰੀ ਤਾਂ ਬਹੁਤ ਲੰਬੀ ਰਹੀ ਸਾਡੇ ਸਕੂਲ ਦੇ ਟੀਚਰਸ ਨੇ ਸਾਨੂੰ ਬਹੁਤ ਪ੍ਰਪਰੇਸ਼ਨ ਕਰਾਈ ਸਾਨੂੰ ਇੱਕ ਡੇਢ ਮਹੀਨਾ ਦੌੜ ਲਗਵਾਉਂਦੇ ਰਹੇ ਜਦੋਂ ਮੈਂ ਸਟਾਰਟਿੰਗ ਵਿੱਚ ਦੌੜ ਵਿਚ ਪਾਰਟੀਸਪੇਟ ਕੀਤਾ ਤਾਂ ਉਦੋਂ ਮੇਰਾ ਰੈਂਕ ਬਹੁਤ ਹੀ ਘੱਟ ਸੀ ਮੈਨੂੰ ਲੱਗਾ ਨਹੀਂ ਸੀ ਕਿ ਜਦੋਂ ਫਾਈਨਲ ਰੇਸ ਹੋਏਗੀ ਤਾਂ ਮੈਂ ਉਹਦੇ ਵਿੱਚ ਕੋਈ ਪੁਜ਼ੀਸ਼ਨ ਲੈ ਵੀ ਪਾਵਾਂਗੀ ਪਰ ਮੇਰੇ ਵਿੱਚ ਜਜ਼ਬਾ ਸੀ ਮੈਂ ਉਸ ਮਹੀਨੇ ਬਹੁਤ ਪ੍ਰੈਕਟਿਸ ਕੀਤੀ ਅਤੇ ਆਪਣੇ ਆਪ ਨੂੰ ਉਭਾਰਿਆ ਜਦੋਂ ਫਾਈਨਲ ਰੇਸ ਹੋਈ ਤਾਂ ਮੈਂ ਫਸਟ ਜਦੋਂ ਪੋਜੀਸ਼ਨ 'ਤੇ ਆਈ ਤਾਂ ਮੈਂ ਬਹੁਤ ਖੁਸ਼ ਹੋਈ ਮੇਰੇ ਮਾਤਾ ਪਿਤਾ ਵੀ ਲਾਗੇ ਸਨ ਤਾਂ ਉਹ ਵੀ ਮੇਰੀ ਖੁਸ਼ੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਮੈਨੂੰ ਇਹ ਉਮੀਦ ਨਹੀਂ ਸੀ ਕਿ ਮੈਂ ਇੱਕ ਮਹੀਨੇ ਵਿੱਚ ਇਹ ਕਰ ਵੀ ਪਾਵਾਂਗੀ ਮੇਰਾ ਇਹ ਅਨੁਭਵ ਬਹੁਤ ਹੀ ਵਧੀਆ ਰਿਹਾ